ਮੈਂ ਤੁਹਾਡੀ ਦੁਕਾਨ ਤੋਂ ਖਾਣ ਪੀਣ ਵਾਲੀਆਂ ਵਸਤੂਆਂ ਲੈ ਕੇ ਗਈ ਸੀ ਉਹ ਸਾਰੀਆਂ ਚੀਜ਼ਾਂ ਬਹੁਤ ਵਧੀਆ ਹਨ ਪਰ ਮੈਂ ਜੋ ਚੀਜ਼ਾਂ ਲੈ ਕੇ ਗਈ ਸੀ ਜਿਵੇਂ ਭੁਜੀਆ ਬਿਸਕੁਟ ਕੋਕ ਮਾਜ਼ਾ ਪੈਟੀਆਂ ਬਰਗਰ ਆਦਿ ਲੈ ਕੇ ਗਈ ਸੀ ਪਰ ਇਹਨਾਂ ਵਿੱਚੋਂ ਕੁਝ ਚੀਜ਼ਾਂ ਮੇਰੀਆਂ ਰਹਿ ਗਈਆਂ ਸਨ ਇਸ ਲਈ ਮੈਂ ਹੋਰ ਚੀਜ਼ਾਂ ਔਡਰ ਕਰਨਾ ਚਾਹੁੰਦੀ ਹਾਂ ਜਿਵੇਂ ਮਾਜ਼ਾ ਨਮਕੀਨ ਪੈਟੀਆਂ ਬਰੈਡ ਆਦਿ ਲੈਣਾ ਚਾਹੁੰਦੀ ਹਾਂ ਇਸ ਲਈ ਤੁਸੀਂ ਮੇਰਾ ਔਡਰ ਜਲਦੀ ਤੋਂ ਜਲਦੀ ਮੇਰੇ ਘਰ ਪਹੁੰਚਾ ਦੇਵੋ ਤਾਂ ਕਿ ਮੇਰੇ ਜੋ ਘਰ ਗੈਸਟ ਆਏ ਹਨ ਮੈਂ ਉਹਨਾਂ ਨੂੰ ਇਹ ਚੀਜ਼ਾਂ ਸਰਵ ਕਰ ਸਕਾਂ ਧੰਨਵਾਦ